ਮੈਂ ਆਪਣੇ ਦੋਸਤ ਦੇ ਵਿਆਹ ਦੇ ਵਿੱਚ ਗਿਆ ਆਨੰਦ ਕਾਰਜ ਉਪਰੰਤ ਬਾਅਦ ਮੈਂ ਇੱਕ ਸਿਹਰਾ ਗਾਇਆ ਜਿਸ ਦੇ ਵਿੱਚ ਕੁੜੀ ਅਤੇ ਮੁੰਡੇ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਕਿ ਵਿਆਹ ਤੋਂ ਬਾਅਦ ਦੀ ਜ਼ਿੰਦਗੀ ਕਿੱਦਾਂ ਚਲਾਉਣੀ ਹੈ ਕਿੱਦਾਂ ਬਤੀਤ ਕਰਨੀ ਹੈ ਉਹਦੇ ਵਿੱਚ ਦੋਨਾਂ ਨੂੰ ਹੀ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਉੱਥੇ ਪਹੁੰਚੇ ਪਤਵੰਤ ਸੱਜਣਾਂ ਨੇ ਇਸ ਨੂੰ ਬਹੁਤ ਸਰਾਹਿਆ ਬਹੁਤ ਪਿਆਰ ਦਿੱਤਾ